ਹੈਲੋ ਹਾਂਜੀ ਸਰ ਅਸੀਂ ਨਾ ਓਲਾ ਤੋਂ ਕੈਬ ਬੁੱਕ ਕੀਤੀ ਸੀਗੀ ਹਾਂਜੀ ਉਹ ਨਾ ਅਸੀਂ ਕੈਂਸਲ ਕਰ ਰਹੇ ਹਾਂ ਕਿਉਂਕਿ ਸਰ ਡਰਾਈਵਰ ਨੇ ਇੰਨੀ ਦੇਰ ਲਗਾ ਦਿੱਤੀ ਕਿ ਨਾ ਤਾਂ ਉਹ ਫ਼ੋਨ ਚੁੱਕ ਰਿਹਾ ਏ ਨਾ ਅਗਰ ਉਹ ਚੁੱਕਦਾ ਏ ਤਾਂ ਉਹਦੀ ਆਵਾਜ਼ ਵੀ ਨਹੀਂ ਆਉਂਦੀ ਹੈਗੀ ਮਤਲਬ ਕਿ ਬਹੁਤ ਪ੍ਰੋਬਲਮਸ ਆ ਰਹੀਆਂ ਏ ਫਿਰ ਮੈਨੂੰ ਦਿੱਲੀ ਜਲਦੀ ਪਹੁੰਚਣਾ ਸੀਗਾ ਮੈਂ ਬਹੁਤ ਜ਼ਿਆਦਾ ਲੇਟ ਹੋ ਰਹੀ ਸੀ ਇਸ ਕਰਕੇ ਮੈਂ ਜਿਹੜੀ ਹੈ ਬੁਕਿੰਗ ਹੈ ਕੈਂਸਲ ਕਰ ਦਿੱਤੀ ਉਹਨਾਂ ਨੂੰ ਮੈਂ ਬਾਰ ਬਾਰ ਬਾਰ ਬਾਰ ਟਰਾਈ ਕੀਤਾ ਫ਼ੋਨ ਕਰਨੇ ਲਈ ਪਰ ਉਹਨਾਂ ਨੇ ਫ਼ੋਨ ਨਹੀਂ ਚੁੱਕਿਆ ਅਗਰ ਜੇ ਚੁੱਕਿਆ ਵੀ ਏ ਉਹਨਾਂ ਦੀ ਆਵਾਜ਼ ਨਹੀਂ ਆਈ ਚੁੱਕ ਕੇ ਅਤੇ ਫਿਰ ਉਹ ਕਹਿ ਰਹੇ ਹੈ ਕਿ ਮੈਂ ਆ ਰਿਹਾ ਹਾਂ ਰਿਹਾ ਬਟ ਉਹ ਹੁਣ ਤੱਕ ਆਇਆ ਨਹੀਂ ਹੈਗਾ ਉਹਨਾਂ ਨੂੰ ਮੈਂ ਜਿਹੜੀ ਲੋਕੇਸ਼ਨ ਭੇਜੀ ਸੀ ਉਹ ਕਹਿ ਰਹੇ ਆ ਕਿ ਤੁਹਾਡੀ ਇਹ ਲੋਕੇਸ਼ਨ ਨਹੀਂ ਸੀ ਬਾਅਦ 'ਚ ਉਹ ਕਹਿੰਦੇ ਕਿ ਤੁਸੀਂ ਦੂਸਰੀ ਲੋਕੇਸ਼ਨ ਪਾਈ ਹੋਈ ਸੀਗੀ ਇਸ ਕਰਕੇ ਮੈਂ ਜਿਹੜੀ ਇਹ ਕੈਂਸਲ ਕਰ ਰਹੀ ਹਾਂ